ਮੋਹਾਲੀ ਜ਼ਿਲ੍ਹੇ ਵਿੱਚ ਰੁਜ਼ਗਾਰ ਅਤੇ ਰੋਸੀ ਰੋਜ਼ੀ ਰੋਟੀ ਦੇ ਜਿਹੜੇ ਮੁੱਖ ਸਰੋਤ ਹੈਗੇ ਹੈ ਨਾ ਖੇਤੀਬਾੜੀ ਹੈ ਅਤੇ ਜਾਂ ਇੰਡਸਟਰੀ ਹੈ ਇਹਨਾਂ ਦੇ ਇਨ੍ਹਾਂ ਕੁ ਵਿੱਚ ਲੋਕ ਜਿਹੜੇ ਹੈ ਕਾਫੀ ਸਾਡੇ ਪ ਜ਼ਿਲ੍ਹੇ ਦੇ ਲੋਕ ਹਨ ਉਹ ਜ਼ਿਆਦਾਤਰ ਲੋਕ ਸਰਕਾਰੀ ਨੌਕਰੀਆਂ ਨੂੰ ਤਰਜੀਹ ਦਿੰਦੇ ਹਨ ਤਾਂ ਜੋ ਸਰਕਾਰੀ ਨੌਕਰੀਆਂ ਨੂੰ ਤਰਜੀਹ ਇਸ ਕਰਕੇ ਦਿੰਦੇ ਹਨ ਕਿਉਂਕਿ ਸਰਕਾਰੀ ਨੌਕ ਨੌਕਰੀ ਵਿੱਚ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ ਇਸ ਤੋਂ ਇਲਾਵਾ ਪੰਜਾਬ ਨੇ ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਸਾਰੀ ਇੰਡਸਟਰੀ ਵੀ ਲੱਗੀ ਹੋਈ ਹੈ ਅਤੇ ਕਾਫੀ ਲੋਕ ਇਹਨਾਂ ਇੰਡਸਟਰੀਆਂ ਵਿੱਚ ਵੀ ਨੌਕਰੀ ਕਰ ਰਹੇ ਹਨ ਅਤੇ ਪਰ ਇੱਥੇ ਸਾਡੇ ਧਿਆਨ ਵਿੱਚ ਆਇਆ ਕਿ ਸਾਡੇ ਜਿਹੜੇ ਜ਼ਿਲ੍ਹੇ ਵਿੱਚ ਹੈ ਬੇਰੁਜ਼ਗਾਰੀ ਕਾਫੀ ਹੱਦ ਤੱਕ ਫੈਲੀ ਹੋਈ ਹੈ ਇਹ ਬੇਰੁਜ਼ਗਾਰੀ ਕੁਝ ਸਰਕਾਰ ਦੀਆਂ ਅੱਛੀਆਂ ਨੀਤੀਆਂ ਨਾ ਹੋਣ ਕਾਰਨ ਵੀ ਹੈ ਅਤੇ ਇਹਦੇ ਬਾਰੇ ਮੈਂ ਸਰਕਾਰ ਨੂੰ ਕੋਈ ਸੁਝਾਅ ਦੇਣਾ ਚਾਹਵਾਂਗਾ ਕਿ ਬੇਰੁਜ਼ਗਾਰਾਂ ਨੂੰ ਉਹਨਾਂ ਦੀ ਯੋਗਤਾ ਮੁਤਾਬਕ ਬਣਦੀਆਂ ਨੌਕਰੀਆਂ ਮੁਹੱਈਆ ਕਰਵਾਈ ਜਾਣ ਜਾਂ ਉਹਨਾਂ ਨੂੰ ਇੰਡਸਟਰੀ ਵਿੱਚ ਕੋਈ ਸਕਿੱਲ ਸਕਿੱਲ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਆਪਣੇ ਕੰਮ ਕਾਰ ਚਲਾ ਸਕਣ ਜਾਂ ਪ੍ਰਾਈਵੇਟ ਤੌਰ 'ਤੇ ਨੌਕਰੀਆਂ ਲੈ ਸਕਣ ਅਤੇ ਇਸ ਤੋਂ ਇਲਾਵਾ ਜਿਵੇਂ ਜੋ ਪੰਜਾਬ ਗਵਰਨਮੈਂਟ ਹੈਗੀ ਆ ਵੱਧ ਤੋਂ ਵੱਧ ਸਰਕਾਰੀ ਨੌਕਰੀਆਂ ਪਬਲਿਸ਼ ਕਰੇ ਤਾਂ ਜੋ ਜਿਹੜੇ ਲੋਕਾਂ ਦੀ ਬੇਰੁਜ਼ਗਾਰੀ ਖਤਮ ਹੋ ਸਕੇ